ਅੱਜ ਕੱਲ੍ਹ ਦੇਖਿਆ ਜਾਵੇ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਪੰਛੀ ਆ ਜਿਵੇਂ ਕਿ ਮੋਰ ਹੋ ਗਿਆ ਕਬੂਤਰ ਹੋ ਗਿਆ ਕਾਂ ਹੋ ਗਿਆ ਕੋਇਲ ਹੋ ਗਈ ਬਾਜ ਹੋ ਗਿਆ ਅਤੇ ਇਹ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਪੰਜਾਬੀ ਉਹ ਪੰਜਾਬੀ ਕਹਿ ਤਾ ਪੰਛੀ ਆ ਅਤੇ ਮੈਂ ਸਰਹੰਦ ਦੇ ਵਿੱਚ ਰਹਿਣ ਵਾਲਾ ਏ ਤਾਂ ਕਰਕੇ ਉਰੇ ਜ਼ਿਆਦਾਤਰ ਮੋਰ ਹੁੰਦੇ ਆ ਕਿਉਂਕਿ ਸਾਡਾ ਜਿਹੜਾ ਸਰਹੰਦ ਦਾ ਮੌਸਮ ਨਾ ਮੌਸਮ ਆ ਨਾ ਉਹ ਠੰਡਾ ਬਹੁਤ ਆ ਅਤੇ ਮੋਰ ਜ਼ਿਆਦਾਤਰ ਠੰਡੀ ਜਗ੍ਹਾ 'ਤੇ ਰਹਿਣ ਨੂੰ ਪਸੰਦ ਕਰਦੇ ਆ ਪਰ ਅਕਸਰ ਕਦੋਂ ਮੈਂ ਦੂਜੇ ਸ਼ਹਿਰ ਤੇ ਟਰੈਵਲ ਕਰਦਾ ਏ ਅਤੇ ਉੱਥੇ ਕਾਂ ਦਾ ਕਾਂ ਬਹੁਤ ਜ਼ਿਆਦਾ ਘੱਟ ਹੁੰਦੇ ਆ ਕਿਉਂਕਿ ਬਾਕੀ ਸੀਟੀਆਂ ਦੇ ਵਿੱਚ ਪੇੜ ਦਾ ਪੇੜ ਬਹੁਤ ਘੱਟ ਆ ਅਤੇ ਮੈਂ ਖੁੱਲ੍ਹੇ ਏਰੀਏ ਦੇ ਵਿੱਚ ਰਹਿੰਦਾ ਏ ਕਿੱਥੇ ਫਰੈਸ਼ ਕਲੈਮਿਟ ਹੋਵੇ ਅਤੇ ਉਹਦੇ ਕਰਕੇ ਸਾਡੇ ਏਰੀਏ ਦੇ ਵਿੱਚ ਕਾਂ ਬਹੁਤ ਆ ਅਤੇ ਉਰੇ ਜ਼ਿਆਦਾਤਰ ਲੋਕਾਂ ਨੇ ਕਾਵਾਂ ਲਈ ਘਰ ਵੀ ਬਣਾਏ ਹੋਏ ਆ ਪੇੜਾਂ 'ਤੇ ਜਿਹਦੇ ਕਰਕੇ ਕਾਂ ਬਚੇ ਰਹਿਣ ਅਤੇ ਕਾਂ ਦਾ ਕਿਹੜਾ ਮਰਨ ਵਾਲਾ ਰੇਟ ਹੋਵੇ ਉਹ ਘੱਟ ਜਾਵੇ ਰੇਟ ਆ ਕਿਹੜਾ ਘੱਟ ਜਾਵੇ ਅਤੇ ਉਰੇ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਕਾਂ ਹੁੰਦੇ ਆ ਅਤੇ ਮੇਰਾ ਜ਼ਿਆਦਾਤਰ ਫੇਵਰੇਟ ਬਰਡ ਹੈਗਾ ਏ ਪੀਕੋਕ ਮੋਰ ਕਿਨੂੰ ਪੰਜਾਬੀ ਦੇ ਵਿੱਚ ਮੋਰ ਕਿਹਾ ਜਾਂਦਾ ਏ ਅਤੇ ਇਹ ਮੇਰਾ ਫੇਵਰੇਟ ਪੰਛੀ ਇਸ ਲਈ ਹੈ ਕਿਉਂਕਿ ਇਹਦੇ ਇਹਦੇ ਕਿਹੜੀ ਬੋਡੀ ਹੁੰਦੀ ਉਹਦੇ ਵਿੱਚ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਰੰਗ ਹੁੰਦੇ ਆ ਅਤੇ ਦੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ ਏ ਅਤੇ ਜੇ ਇਹਦੇ ਸਰੀਰ ਦੇ ਬਾਰੇ ਗੱਲ ਕੀਤੀ ਜਾਵੇ ਇਹਦੇ ਸਰੀਰ ਦੇ ਵਿੱਚ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਰੰਗ ਹੁੰਦੇ ਆ ਅਤੇ ਪੀਕੋਕ ਕਿਹੜਾ ਹੁੰਦਾ ਉਹਨੂੰ ਵਧੀਆ ਵੀ ਮੰਨਿਆਂ ਜਾਂਦਾ ਏ ਅਤੇ ਜ਼ਿਆਦਾਤਰ ਪੀਕੋਕ ਹੁੰਦੇ ਕਿਹੜੇ ਆਮ ਖਾਸ ਬਾਗ ਵਿੱਚ ਰਹਿੰਦੇ ਆ ਆਮ ਖਾਸ ਬਾਗ ਦੇ ਵਿੱਚ ਇਸੇ ਕਰਕੇ ਰਹਿੰਦੇ ਆ ਕਿਉਂਕਿ ਉੱਥੇ ਪੂਰਾ ਖੁੱਲ੍ਹਾ ਕਲੈਮਿਟ ਆ ਅਤੇ ਬਹੁਤ ਜ਼ਿਆਦਾ ਟਰੀ ਆ ਅਤੇ ਕਿਹੜਾ ਪੀਕੋਕ ਬਰਡ ਹੁੰਦਾ ਦੇਖਣ ਨੂੰ ਵੀ ਬਹੁਤ ਸੋਹਣਾ ਹੁੰਦਾ ਏ ਉਹਦੇ ਦੇ ਵਿੱਚ ਜ਼ਿਆਦਾਤਰ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਰੰਗ ਹੁੰਦੇ ਆ ਜਿਵੇਂ ਕਿ ਨੀਲਾ ਰੰਗ ਹੋ ਗਿਆ ਹਰਾ ਰੰਗ ਹੋ ਗਿਆ ਅਤੇ ਉਹਦੇ ਬਹੁਤ ਜ਼ਿਆਦਾ ਖੰਭ ਹੁੰਦੇ ਅਤੇ ਸਵੇਰ ਦੇ ਟਾਇਮ ਕਿਹੜੇ ਹੁੰਦੇ ਆ ਮੋਰ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਅਤੇ ਉਹ ਆਪਣੇ ਕਿਹੜੇ ਖੰਭ ਹੁੰਦੇ ਆ ਖਲਾਰਦੇ ਆ ਉੱਥੇ ਅਤੇ ਕਈ ਵਾਰ ਉਹ ਡਾਂਸ ਵੀ ਕਰਦੇ ਆ ਖੁਸ਼ੀ ਖੁਸ਼ੀ ਦੇ ਵਿੱਚ ਕਿਹੜੇ ਪੀਕੋਕ ਪੰਛੀ ਹੁੰਦੇ ਆ ਉਹ ਬਹੁਤ ਜ਼ਿਆਦਾ ਸੋਹਣੇ ਹੁੰਦੇ ਆ ਅਤੇ ਕਿਹਾ ਜਾਵੇ ਸਾਰੇ ਲੋਕਾਂ ਨੂੰ ਪੰਛੀਆਂ ਲਈ ਬ ਅਲੱਗ ਅਲੱਗ ਕੁਛ ਕਰਨਾ ਚਾਹੀਦਾ ਕਿਹਦੇ ਕਰਕੇ ਪੰਛੀ ਆਰਾਮ ਨਾਲ ਬਚੇ ਰਹਿਣ